ਸਤਿ ਸ਼੍ਰੀ ਅਕਾਲ ਮੈਂ ਪਰਮਜੀਤ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਅੱਜ ਕੱਲ੍ਹ ਇਸ ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ ਹਨ ਜੋ ਸਿਲਾਈ ਦੇ ਕੰਮ ਨੂੰ ਬੜਾ ਹੀ ਸੌਖਾ ਕਰ ਦਿੰਦੀਆਂ ਹਨ ਜਿਵੇਂ ਸਵੈਟਰ ਬੁਣਨ ਵਾਲੀ ਮਸ਼ੀਨ ਜਿਸ ਵਿੱਚ ਅਸੀਂ ਡਜ਼ਾਇਨ ਵਾਲੇ ਸਵੈਟਰ ਜੁਰਾਬਾਂ ਕੋਟੀਆਂ 'ਤੇ ਤਰ੍ਹਾਂ ਤਰ੍ਹਾਂ ਦੀਆਂ ਡਿਜ਼ਾਈਨਾਂ ਬਾਕੀ ਟੋਪੀਆਂ ਬਣਾਉਂਦੇ ਹਾਂ ਜਿਵੇਂ ਕਿ ਸਿਲਾਈ ਵ ਵਾਲੀ ਮਸ਼ੀਨ ਵਿੱਚ ਪੋਂਚੇ ਬਣਾਉਣ ਵਾਲੀ ਮਸ਼ੀਨ ਇੰਟਰਲੋਕ ਵਾਲੀ ਮਸ਼ੀਨ ਅਤੇ ਪੀਕੋ ਪੀਕੋ ਕਰਨ ਵਾਲੀ ਮਸ਼ੀਨ ਅਤੇ ਮਸ਼ੀਨਾਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਵਿੱਚ ਜਿਸ ਮਸ਼ੀਨ ਨਾਲ ਲੋਕ ਤਰਪਾਈ ਵੀ ਕਰ ਲੈਂਦੇ ਹਨ ਤਾਂ ਮੈਂ

ਅਤੇ ਮੈਂ ਇਹ ਗਾਹਕ ਦੀ ਪਸੰਦ ਲਈ ਸਿੰਪਲ ਸੂਟ 'ਤੇ ਕਈ ਤਰ੍ਹਾਂ ਦੇ ਡਜ਼ਾਇਨ ਵਾਲੇ ਸੂਟ ਪਸੰਦ ਕਰਦੇ ਹਨ ਪਰ ਮੈਨੂੰ ਸਿੰਪਲ ਸੂਟ ਹੀ ਪਸੰਦ ਹੈ ਪਹਿਲਾਂ ਲੋਕ ਹੱਥ ਨਾਲ ਮਸ਼ੀਨ ਚਲਾਉਂਦੇ ਸਨ ਅੱਜ ਦੀ ਤਕਨੀਕ ਵਿੱਚ ਪੈਰਾਂ ਵਾਲੀ ਮਸ਼ੀਨ ਅਤੇ ਬਿਜਲੀ 'ਤੇ ਚੱਲਣ ਵਾਲੀ ਮਸ਼ੀਨ ਮੋਟਰ ਲਗਾ ਕੇ ਅਤੇ ਕੱਪੜੇ ਸੀਤੇ ਜਾਂਦੇ ਹਨ ਅਤੇ ਕੰਮ ਤਿਆਰ ਹੋ ਜਾਂਦਾ ਹੈ ਜਿਸ ਨਾਲ ਸਾਨੂੰ ਬਿਹਤਰ ਮਹਿਸੂਸ ਹੁੰਦਾ ਹੈ ਧੰਨਵਾਦ